ਜਦੋਂ ਸਾਡੇ ਸਰੀਰ ਵਿੱਚ ਕੋਈ ਬੜੀ ਬਿਮਾਰੀ ਹੁੰਦੀ ਹੈ ਤਾਂ ਜਾਂ ਸਾਨੂੰ ਲੱਗਦਾ ਹੈ ਵੀ ਸਾਡੇ ਸਰੀਰ ਵਿੱਚ ਜ਼ਿਆਦਾ ਖ਼ਰਾਬੀ ਹੈ ਅਤੇ ਅਸੀਂ ਹਸਪਤਾਲ ਵਿੱਚ ਦਿਖਾਉਣਾ ਜ਼ਰੂਰੀ ਸਮਝਦੇ ਹਾਂ ਕਿਉਂਕਿ ਸ ਐਹ ਜਿਹੀਆਂ ਬਿਮਾਰੀਆਂ ਦਾ ਇਲਾਜ ਘਰੇਲੂ ਨਹੀਂ ਕੀਤਾ ਜਾ ਸਕਦਾ ਅਤੇ ਅਸੀਂ ਸਮਝਦੇ ਹਾਂ ਕਿ ਹੋਸ ਹਸਪਤਾਲਾਂ ਵਿੱਚ ਹੀ ਇਹਦਾ ਇਲਾਜ ਕਰਾਉਣਾ ਚੰਗਾ ਹੈ ਅਤੇ ਜਿਸ ਨਾਲ ਸਾਨੂੰ ਡਾਕਟਰ ਚੰਗੀ ਰਾਏ ਦੇ ਸਕਦੇ ਹਨ ਅਤੇ ਸਾਡਾ ਚੰਗਾ ਇਲਾਜ ਕਰ ਸਕਦੇ ਹਨ ਅਤੇ ਜਿਸ ਕਾਰਨ ਸਾਡਾ ਸਰੀਰ ਤੰਦਰੁਸਤ ਰਹੇ ਅਜੋ ਸਾਨੂੰ ਛੋਟੀ ਮੋਟੀ ਬਿਮਾਰੀਆਂ ਹੁੰਦੀਆਂ ਹਨ ਜਿਵੇਂ ਸਰੀਰ ਸਿਰ ਦੁੱਖਣਾ ਜਾਂ ਜ਼ੁਕਾਮ ਹੋ ਜਾਣਾ ਜਾਂ ਖਾਂਸੀ ਹੋ ਜਾਣੀ ਜਾਂ ਜਾਂ ਕੁਝ ਵੀ ਹੋ ਜਾਣਾ ਛੋਟਾ ਮੋਟਾ ਤਾਂ ਅਸੀਂ ਉਹਦਾ ਇਲਾਜ ਘਰੇਲੂ ਹੀ ਕਰਦੇ ਹਾਂ ਅਤੇ ਜਿਸ ਕਰਕੇ ਜੇ ਸਾਨੂੰ ਜ਼ੁਕਾਮ ਵਗੈਰਾ ਹੋ ਜਾਂਦਾ ਹੈ ਤਾਂ ਅਸੀਂ ਗਰਮ ਪਾਣੀ ਪੀਂਦੇ ਹਾਂ ਜਾਂ ਸਟੀਮ ਲੈਦੇ ਸਟੀਮ ਲੈਂਦੇ ਹਾਂ ਅਤੇ ਅਸੀਂ ਸ ਅਤੇ ਅਸੀਂ ਸ਼ਹਿਦ ਵੀ ਲੈਂਦੇ ਹਾਂ ਅਤੇ ਖਾਣਾ ਖਾਣ ਤੋਂ ਬਾਅਦ ਅਸੀਂ ਥੋੜ੍ਹਾ ਗੁੜ ਵੀ ਖਾਂਦੇ ਹਾਂ ਜਿਸ ਨਾਲ ਕਿ ਸਾਡਾ ਪਾਚਨ ਕਿਰਿਆ ਸਹੀ ਚੱਲਦੀ ਰਹੇ ਅਤੇ ਅਤੇ ਸਾਡਾ ਜਿਹੜਾ ਖਾਣਾ ਪੀਣਾ ਹੈ ਉਹ ਚੰਗੇ ਤਰੀਕੇ ਨਾਲ ਹਜਮ ਹੁੰਦਾ ਰਹੇ ਅਤੇ ਅਸੀਂ ਚਾਹ ਵੀ ਅਦਰਕ ਵਾਲੀ ਪੀਂਦੇ ਹਾਂ ਜਿਸ ਕਾਰਨ ਕਿ ਅ ਸਾਡਾ ਹਾਜਮਾ ਸਹੀ ਰਹੇ ਤਾਂ ਅਸੀਂ ਸਰਦੀਆਂ ਵਿੱਚ ਪੰਜੀਰੀ ਬਣਾ ਕੇ ਰੱਖਦੇ ਹਾਂ ਅਤੇ ਪੰਜੀਰੀ ਵੀ ਖਾਂਦੇ ਹਾਂ ਅਤੇ ਜਿਸ ਕਰਕੇ ਵੀ ਸਾਡੇ ਸਰੀਰ ਵਿੱਚ ਤਾਕਤ ਬਣੀ ਰਹੇ ਅਤੇ ਅਸੀਂ ਰਾਤ ਨੂੰ ਅਖਰੋਟ ਅਤੇ ਬਦਾਮ ਭਿਓਂ ਕੇ ਰੱਖਦੇ ਹਾਂ ਅਤੇ ਸਵੇਰੇ ਉਹਨਾਂ ਦਾ ਸੇਵਨ ਕਰਦੇ ਹਾਂ ਜਿਸ ਕਾਰਨ ਕਿ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਉਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹਨ ਅਤੇ ਜਿਵੇਂ ਅਸੀਂ ਘਰੇ ਇਲਾਜ ਕਰਦੇ ਹਾਂ ਤਾਂ ਉਸ ਨਾਲ ਵੀ ਸਾਡੀ ਬੱਚਤ ਵੀ ਹੁੰਦੀ ਹੈ ਅਤੇ ਸਾਰਾ ਕੁਝ ਤੰਦਰੁਸਤ ਰਹਿੰਦਾ ਹੈ ਅਤੇ ਅਤੇ ਘਰੇਲੂ ਇਲਾਜ ਬਹੁਤ ਸਹੀ ਹਨ ਅਤੇ ਉਹ ਛੋਟੇ ਮੋਟੇ ਬਿਮਾਰੀਆਂ ਨੂੰ ਸਾਨੂੰ ਘਰ ਹੀ ਠੀਕ ਕਰ ਲੈਣਾ ਚਾਹੀਦਾ ਹੈ ਘਰੇਲੂ ਇਲਾਜ ਨਾਲ ਕਿਉਂਕਿ ਘਰੇਲੂ ਇਲਾਜ ਨਾਲ ਹੀ ਮਨੁਸ਼ ਦੀ ਬੱਚਤ ਵੀ ਹੁੰਦੀ ਹੈ ਅਤੇ ਟਾਈਮ ਵੀ ਦੀ ਬੱਚਤ ਵੀ ਹੁੰਦੀ ਹੈ ਅਤੇ ਜਿਸ ਕਰਕੇ ਹੀ ਅਸੀਂ ਜਿਵੇਂ ਵੀ ਸਾਨੂੰ ਲੱਗਦਾ ਹੈ ਕਿ ਸਾਨੂੰ ਜਾਂ ਕੋਈ ਛੋਟੀ ਮੋਟੀ ਹੋਰ ਬਿਮਾਰੀ ਹੈ ਤਾਂ ਅਸੀਂ ਸਾਰਾ ਕੁਝ ਐਵੇਂ ਹੀ ਦੇਸੀ ਨੁਸਖਿਆਂ ਨਾਲ ਅਸੀਂ ਸਹੀ ਕਰ ਲੈਂਦੇ ਹਾਂ ਅਤੇ ਜਿਵੇਂ ਕਿ ਕਾੜਾ ਵੀ ਬਣਾ ਕੇ ਪੀਂਦੇ ਹਾਂ ਵੀ ਜਦੋਂ ਸਾਨੂੰ ਲੱਗਦਾ ਹੈ ਵੀ ਜਾਂ ਖਾਂਸੀ ਜਾਂ ਜ਼ੁਕਾਮ ਜ਼ਿਆਦਾ ਹੈ ਤਾਂ ਅਸੀਂ ਵਿੱਚ ਅਖਰੋਟ ਬਦਾਮ ਦਾਖਾਂ ਪਾ ਕੇ ਅਸੀਂ ਉਹਦਾ ਕਾੜਾ ਬਣਾ ਕੇ ਅਸੀਂ ਘਰ ਹੀ ਪੀਂਦੇ ਹਾਂ ਅਤੇ ਜਿਸ ਕਾਰਨ ਇਹ ਸਾਡੇ ਸਰੀਰ ਨੂੰ ਬਹੁਤ ਫਾਇਦਾ ਕਰਦਾ ਹੈ ਅਤੇ ਸਾਨੂੰ ਐਵੇਂ ਹੀ ਕਰਨਾ ਚਾਹੀਦਾ ਹੈ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹਨ ਅਤੇ ਸਾਨੂੰ ਘਰੇਲੂ ਨੁਸਖਿਆਂ ਨੂੰ ਘਰ ਹੀ ਵਰਤ ਲੈਣਾ ਚਾਹੀਦਾ ਹੈ ਅਤੇ ਸਾਡੇ ਸਰੀਰ ਨੂੰ ਬਹੁਤ ਤੰਦਰੁਸਤ ਰੱਖਦੇ ਹਨ